ਸਿੱਖਿਆ ਦੇ ਖੇਤਰ ਵਿੱਚ ਨੌਜਵਾਨਾਂ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਆ ਰਹੀਆਂ ਹਨ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਆਵਾਜਾਈ ਦੇ ਸਾਧਨ ਸਰਕਾਰੀ ਕਾਲਜ ਅਤੇ ਯੂਨੀਵਰਸਿਟੀਆਂ ਪਿੰਡਾਂ ਤੋਂ ਕਾਫੀ ਦੂਰ ਸ਼ਹਿਰਾਂ ਵਿੱਚ ਹੋਣ ਕਰਕੇ ਬੱਚਿਆਂ ਨੂੰ ਰੋਜ਼ਾਨਾ ਆਉਣਾ ਜਾਣਾ ਔਖਾ ਹੈ ਅਤੇ ਜੇਕਰ ਉਹ ਪੀ ਜੀ ਦਾ ਪ੍ਰਬੰਧ ਵੀ ਕਰਦੇ ਹਨ ਅਤੇ ਉਹਨਾਂ ਦਾ ਕਿਰਾਇਆ ਅਤੇ ਪੜ੍ਹਾਈ ਦੇ ਖਰਚੇ ਪਾ ਕੇ ਕਾਫੀ ਰਕਮ ਬਣ ਜਾਂਦੀ ਹੈ ਮੈਡੀਕਲ ਕਾਲਜ ਦੀ ਪੜ੍ਹਾਈ ਕਰਨ ਲਈ ਫਰੀਦਕੋਟ ਅਤੇ ਅੰਮ੍ਰਿਤਸਰ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਜਾ ਕੇ ਰਹਿਣਾ ਅਤੇ ਸਾਰਾ ਖਰਚਾ ਕਰਨਾ ਮਾਪਿਆਂ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਂਦਾ ਹੈ ਜੇਕਰ ਔਖੇ ਸੌਖੇ ਕੁਝ ਬੱਚੇ ਡਿਗਰੀਆਂ ਕਰ ਵੀ ਲੈਂਦੇ ਹਨ ਤਾਂ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਕਾਫੀ ਘੱਟ ਹਨ ਪੜ੍ਹੇ ਲਿਖੇ ਨੌਜਵਾਨ ਛੋਟੀਆਂ ਨੌਕਰੀਆਂ ਕਰਨ ਵਿੱਚ ਅਸਮਰਥ ਹਨ ਕਿਉਂਕਿ ਉਹਨਾ ਦਾ ਖਰਚਾ ਪਾਣੀ ਵੀ ਪੂਰਾ ਨਹੀ ਹੁੰਦਾ ਰਿਸ਼ਵਤਖੋਰੀ ਵੀ ਇਕ ਬਹੁਤ ਵੱਡੀ ਚੁਣੌਤੀ ਹੈ ਡਿਗਰੀਆਂ ਪਾਸ ਕੀਤੇ ਹੋਏ ਬੱਚਿਆਂ ਦੇ ਲਈ ਨੌਕਰੀਆਂ ਲੈਣਾ ਜਾਂ ਡਿਗਰੀਆਂ ਕਰਨ ਵਾਸਤੇ ਐਡਮਿਸ਼ਨਾਂ ਲੈਣੀਆ ਰਿਸ਼ਵਤ ਦੇ ਕੇ ਲੈਣਾ ਪੈ ਲੈਣੀਆ ਪੈਂਦੀਆਂ ਹਨ ਜੋ ਕਿ ਕਈ ਹੋਣਹਾਰ ਵਿਦਿਆਰਥੀ ਪਿੱਛੇ ਰਹਿ ਜਾਂਦੇ ਹਨ ਜਿਸ ਕਰਕੇ ਦੂਜੇ ਪੱਖ 'ਤੇ ਵੇਖੀਏ ਤਾਂ ਕਾਫੀ ਕਾਲਜ ਵਿੱਚ ਬਹੁਤ ਸਾਰੇ ਕੋਰਸਾਂ ਦਾ ਵੀ ਪ੍ਰਬੰਧ ਹੈ ਜਿਸ ਕਰਕੇ ਬੱਚੇ ਅਸਾਨੀ ਨਾਲ ਆਪਣੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੂਰੀ ਕਰ ਲੈਂਦੇ ਹਨ ਜਿਸ ਕਰਕੇ ਉਹ ਕਾਫੀ ਪ੍ਰਾਈਵੇਟ ਨੌਕਰੀਆਂ ਕਰਕੇ ਆਪਣੇ ਨਿੱਜੀ ਖਰਚੇ ਕੱਢ ਸਕਦੇ ਹਨ ਅਤੇ ਆਪਣੇ ਮਾਂ ਪਿਓ ਦੀ ਸਹਾਇਤਾ ਕਰ ਸਕਦੇ ਹਨ